ਹਾਂਜੀ ਸਿਹਤ ਸਹੂਲਤਾਂ ਦੇ ਵਿੱਚ ਪਿਛਲੇ ਵੀਹ ਸਾਲਾਂ ਦੇ ਨਾਲੋਂ ਜੇ ਹੁਣ ਨਜ਼ਰ ਮਾਰੀਏ ਤਾਂ ਬਹੁਤ ਜ਼ਿਆਦਾ ਸੁਧਾਰ ਹੋਇਆ ਹੈਗਾ ਕਿੰਨੇ ਕਾਬਲ ਡਾਕਟਰ ਆ ਗਏ ਸਾਡੇ ਹੋਸਪਿਟਲ ਦੇ ਵਿੱਚ ਦਵਾਈਆਂ ਦਾ ਵੀ ਵਧੀਆ ਪ੍ਰਬੰਧ ਹੈਗਾ ਅਤੇ ਜਿਹੜਾ ਆਪਣਾ ਲੋੜੀਂਦੇ ਬੈਡ ਬੁੱਡ ਵੀ ਉਪਲਬਧ ਹੁੰਦੇ ਨੇ ਬਟ ਜਦੋਂ ਕਈ ਵਾਰ ਜਿਵੇਂ ਲਾਇਕ ਆ ਕਰੋਨਾ ਵਗੈਰਾ ਆ ਗਿਆ ਸੀ ਉਦੋਂ ਇਹ ਸਾਰੇ ਕਿਤੇ ਹੀ ਬਿਮਾਰੀ ਪਈ ਹਾਂ ਉਦੋਂ ਚੀਜ਼ਾਂ ਦੀ ਘਾਟ ਪੈਂਦੀ ਹੈ ਡਾਕਟਰ ਵੀ ਉਦੋਂ ਇੰਨੇ ਜ਼ਿਆਦਾ ਨਹੀਂ ਉਪਲੱਬਧ ਹੁੰਦੇ ਮੈਡੀਸਨ ਦੀ ਘਾਟ ਹੋ ਜਾਂਦੀ ਹੈ ਬੈਡਾਂ ਦੀ ਘਾਟ ਹੋ ਜਾਂਦੀ ਹੈ ਤਾਂ ਜਿਹੜਾ ਕਿ ਮਰੀਜ਼ਾਂ ਨੂੰ ਵਗੈਰਾ ਵਗੈਰਾ ਦੀ ਹੋਣਾ ਪੈ ਜਾਂਦਾ ਹੈਗਾ ਹੈ ਨਾ ਤਾਂ ਜੇ ਕਈ ਵਾਰ ਆਪਾਂ ਦੇਖਦੇ ਆ ਵੀ ਇਹ ਲੇਡੀਜ ਡਾਕਟਰ ਜਿਹਦੀ ਗਾਇਨੋਸਟਰ ਡਾਕਟਰ ਹੁੰਦੇ ਹੈ ਉਹਨਾਂ ਦੀ ਵੀ ਘਾਟ ਹੁੰਦੀ ਹੈ ਤੋ ਡਿਲੀਵਰੀ ਵਗੈਰਾ ਕਈ ਵਾਰ ਰਾਤ ਨੂੰ ਹੁੰਦੀ ਹੈ ਤਾਂ ਉਹ ਪਿੰਡੋਂ ਲੋਕ ਸ਼ਹਿਰ ਤੋਂ ਲੈ ਕੇ ਜਾਂਦੇ ਆ ਕਈ ਵਾਰ ਮੌਕੇ 'ਤੇ ਡਾਕਟਰ ਨਹੀਂ ਮਿਲਦਾ ਤਾਂ ਉਦੋਂ ਜਿਹੜਾ ਕੀ ਆ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈਗਾ ਮਰੀਜ਼ਾਂ ਨੂੰ ਮੇ ਛੋਟੇ ਸ਼ਹਿਰ 'ਚ ਲੈ ਕੇ ਜਾਂਦੇ ਹੈ ਛੋਟੇ ਵਾਲੇ ਫਿਰ ਜ਼ਿਲ੍ਹੇ ਵਾਲੇ 'ਚ ਉਹਨੂੰ ਰੈਫ਼ਰ ਕਰਦੇ ਆ ਉਦੋਂ ਨੂੰ ਕੁਝ ਨਾ ਕੁਛ ਕਈ ਚਲੋ ਜੇ ਕਿਸਮਤ ਚੰਗੀ ਹੋਵੇ ਤਾਂ ਸਾਰਾ ਕੁਝ ਠੀਕ ਹੋ ਜਾਂਦਾ ਬਟ ਕਈ ਵਾਰੀ ਜਿਹੜੇ ਸ ਅਣਸਖਾਵੀਆਂ ਘਟਨਾਵਾਂ ਵੀ ਵਾਪਰਦੀਆਂ ਹੈਗੀਆਂ ਇਸ ਲਈ ਜਿਹੜੇ ਛੋਟੇ ਸ਼ਹਿਰਾਂ ਵਾਲੇ ਹੋਸਪਿਟਲ ਹੈ ਉਹਨਾਂ ਨੂੰ ਵੀ ਉੱਦਾਂ ਦੀਆਂ ਜਿਹੜੀਆਂ ਸਰਕਾਰ ਨੂੰ ਮੈਂ ਬੇਨਤੀ ਕਰਦਾ ਜ਼ਰੂਰ ਸਹੂਲਤਾਂ ਪ੍ਰਦਾਨ ਕਰਨ